ਮੋਬਾਇਲ ਫ਼ੋਨ ਜਿੱਥੇ ਅੱਜ ਹਰੇਕ ਵਿਅਕਤੀ ਦੀ ਲੋੜ ਬਣ ਗਈ ਹੈ ਪਰ ਇਸ ਦੇ ਕਾਫੀ ਨੁਕਸਾਨ ਵੀ ਹਨ ਜਿਵੇਂ ਕਿ ਕੰਮਾਂ ਕਾਰਾਂ ਨੂੰ ਛੱਡ ਕੇ ਆਪਾਂ ਮੋਬਾਇਲ ਫ਼ੋਨ 'ਤੇ ਨਾਲ ਬੰਨ ਜਾਂਦੇ ਹਾਂ ਜਿਸਦੇ ਲਈ ਸਾਨੂੰ ਰੋਟੀ ਪਾਣੀ ਵੀ ਖਾਣਾ ਨਸੀਬ ਨਹੀਂ ਹੁੰਦਾ ਅਸੀਂ ਇਸ ਪ੍ਰੋਡਕਟ ਦੇ ਵਿੱਚ ਮੋਬਾਇਲ ਫ਼ੋਨ ਜਿਸਦਾ ਨਾਂ ਹੈ ਆਪਣੇ ਆਪ ਨੂੰ ਇੰਨਾ ਖੁਬਾਹ ਲਿਆ ਹੈ ਕਿ ਅਸੀਂ ਰਾਤ ਨੂੰ ਬਾਰਾਂ ਬਾਰਾਂ ਵਜੇ ਤੱਕ ਵੀ ਮੋਬਾਇਲ ਫ਼ੋਨ 'ਤੇ ਵਟਸਐਪ ਫੇਸਬੁੱਕ ਆਦਿ ਦੇਖਦੇ ਰਹਿੰਦੇ ਹਾਂ ਜਿਹੜੇ ਕਿ ਕਈ ਚੀਜ਼ਾਂ ਸਾਨੂੰ ਲੋੜ ਨਹੀਂ ਹੈ ਉਹ ਵੀ ਅੱਜ ਦੇ ਸਮੇਂ ਵਿੱਚ ਸ਼ੋਸ਼ਲ ਮੀਡੀਆ 'ਤੇ ਪਰੋਸੀਆਂ ਜਾ ਰਹੀਆਂ ਹਨ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ